ਅੱਜ ਕੱਲ੍ਹ ਦੇ ਯੁੱਗ ਵਿੱਚ ਖੇਡਾਂ ਦਾ ਬਹੁਤ ਹੀ ਜ਼ੋਰ ਹੈ ਜਿਵੇਂ ਕਿ ਵਾਲੀਬੋਲ ਕਬੱਡੀ ਹੋਕੀ ਕ੍ਰਿਕਟ ਅਜਿਹੀਆਂ ਖੇਡਾਂ ਅੱਜ ਹਰ ਇੱਕ ਪੱਧਰ 'ਤੇ ਖੇਡੀਆਂ ਜਾ ਰਹੀਆਂ ਆ ਵਰਲਡਵਾਈਡ ਵੀ ਪੰਜਾਬ 'ਤੇ ਵੀ ਜਾਂ ਨੈਸ਼ਨਲ ਲੈਵਲ 'ਤੇ ਵੀ ਜੇਕਰ ਅਸੀਂ ਪਿੰਡਾਂ ਦੀ ਖੇਡਾਂ ਦੀ ਗੱਲ ਕਰੀਏ ਉਹਨਾਂ ਵਿੱਚ ਵੀ ਅਜਿਹੀਆਂ ਖੇਡਾਂ ਸ਼ਾਮਿਲ ਹਨ ਜਿਹਨਾਂ ਵਿੱਚੋਂ ਸਭ ਤੋਂ ਵਧੀਆ ਖੇਡ ਹੈ ਕਬੱਡੀ ਕਬੱਡੀ ਇੱਕ ਅਜਿਹੀ ਖੇਡ ਹੈ ਜੋ ਬੰਦੇ ਨੂੰ ਕਾਲਾ ਸ਼ਰੀਰੋਂ ਕਾਲਾ ਬਣਾਉਂਦੀ ਹੈ ਨਾਲੇ ਬੰਦੇ ਨੂੰ ਸ ਮਾਨਸਿਕ ਤੰਦਰੁਸਤੀ ਵੀ ਤੇਜ਼ ਕਰਦੀ ਹੈ ਨਾਲੇ ਬੰਦੇ ਨੂੰ ਵਧੀਆ ਬਣਾਉਂਦੀ ਹੈ ਜੇਕਰ ਅਸੀਂ ਗੱਲ ਕਰੀਏ ਆਪਸੀ ਭਾਈਚਾਰੇ ਦੇ ਪਿੰਡਾਂ ਵਿੱਚ ਪਿੰਡਾਂ ਵਿੱਚ ਜੇ ਬੰਦਾ ਕਿ ਕਿਸੇ ਵੀ ਖੇਡ ਨੂੰ ਜੁਆਇਨ ਕਰਦਾ ਹੈ ਉਹ ਆਪਸੀ ਭਾਈਚਾਰਾ ਤਾਂ ਬਣਦਾ ਹੀ ਬਣਦਾ ਨਾਲੇ ਉਹਨਾਂ ਦੀ ਆਪਸੀ ਮਿਲਵਰਤਨ ਵੀ ਵਧੀਆ ਹੋ ਜਾਂਦਾ ਹੈ ਜਿਵੇਂ ਕਿ ਆਹ ਸਾਂਝ ਵਧੀਆ ਹੋ ਜਾਂਦੀ ਹੈ ਨਾਲੇ ਆਪਸੀ ਆਪਸ ਵਿੱਚ ਖੇਡਣ ਵਿੱਚ ਖੇਡਣ ਦੇ ਨਾਲ ਨਾਲ ਉਹਨਾਂ ਨੂੰ ਕਈ ਹੋਰ ਸਾਰੇ ਵਧੀਆ ਟੈਕਨੀਕਸ ਵੀ ਖੇਡਣ ਨੂੰ ਮਿਲ ਸਿੱਖਣ ਨੂੰ ਮਿਲ ਜਾਂਦੀਆਂ ਹਨ ਜੇਕਰ ਅਸੀਂ ਹੋਰ ਵੀ ਖੇਡਾਂ ਦੀ ਗੱਲ ਕਰੀਏ ਕਬੱਡ ਕਬੱਡੀ ਤੋਂ ਇਲਾਵਾ ਕ੍ਰਿਕਟ ਵੀ ਅੱਜ ਕੱਲ੍ਹ ਪਿੰਡਾਂ ਵਿੱਚ ਬਹੁਤ ਹੀ ਹਾਈ ਪੈਮਾਨੇ 'ਤੇ ਖੇਡਿਆ ਜਾ ਰਿਹਾ ਵੱਡੇ ਪੱਧਰ 'ਤੇ ਖੇਡਿਆ ਜਾ ਰਿਹਾ ਉੱਥੇ ਪਿੰਡਾਂ ਵਿੱਚ ਕਈ ਲੋਕੀ ਟੂਰਨਾਮੈਂਟ ਵੀ ਆਰਗਨਾਈਜ਼ ਕਰਦੇ ਹਨ ਜਿਹਨਾਂ ਨਾਲ ਕਿ ਬੱਚੇ ਪ੍ਰਭਾਵਿਤ ਹੋ ਕੇ ਆਉਂਦੇ ਉੱਥੇ ਆਉਂਦੇ ਹਨ ਉਹਦੇ ਵਿੱਚ ਕੋਈ ਕੁਝ ਇਨਾਮ ਵੀ ਦਿੱਤੇ ਜਾਂਦੇ ਆ ਜਿਵੇਂ ਕਿ ਇੱਕੀ ਸੌ ਦਾ ਇਨਾਮ ਹੋ ਗਿਆ ਗਿਆਰ੍ਹਾਂ ਸੌ ਦਾ ਇਨਾਮ ਹੋ ਗਿਆ ਇਦ ਇਹਨੂੰ ਦੇਖ ਕੇ ਬੱਚੇ ਪ੍ਰਭਾਵਿਤ ਹੁੰਦੇ ਨੇ ਅਤੇ ਉਤਸ਼ਾਹਿਤ ਹੁੰਦੇ ਨੇ ਅਤੇ ਨਾਲੇ ਕੇੜਾ ਖੇਡਾ ਖੇਡਣ ਆਉਂਦੇ ਹਨ ਜਦੋਂ ਖੇਡੇ ਇਹੋ ਜਿਹੇ ਖੇਡਾਂ ਚੱਲਦੀਆਂ ਹਨ ਉੱਥੇ ਬੜਾ ਆਨੰਦ ਅਤੇ ਉਤਸ਼ਾਹ ਚੱਲ ਹੁੰਦਾ ਹੈ ਲੋਕ ਦੂਰੋਂ ਦੂਰੋਂ ਦੇਖਣ ਆਉਂਦੇ ਹਨ ਨਾਲੇ ਕਿ ਹੋਰ ਵੀ ਲੋਕ ਆਸੇ ਪਾਸੇ ਦੇ ਜਿਵੇਂ ਕਿ ਮੰਤਰੀ ਹੋ ਗਏ ਉਹ ਵੀ ਐਜ ਏ ਚੀਫ ਗੈਸਟ ਸੱਦੇ ਜਾਂਦੇ ਹਨ